ਸਰਕਾਰ ਅੱਗੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਬਹੁਤ ਸਕੀਮਾਂ ਸ਼ੁਰੂ ਕਰ ਦਿੰਦੇ ਹੋ ਪਰੰਤੂ ਜੋ ਨਿਚਲੇ ਦਰਜੇ ਦੇ ਅਧਿਕਾਰੀ ਹਨ ਉਹ ਇਹ ਸਕੀਮਾਂ ਨੂੰ ਪੇਂਡੂ ਖੇਤਰਾਂ ਵਿੱਚ ਨਹੀਂ ਲੈ ਕੇ ਜਾਂਦੇ ਇਸ ਲਈ ਇਹ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਨੁਮਾਇੰਦੇ ਭੇਜੋ ਤਾਂ ਜੋ ਪਤਾ ਲੱਗ ਸਕੇ ਕਿ ਤੁਹਾਡੀਆਂ ਸਕੀਮਾਂ ਦਾ ਕਿ ਕਿੰਨਾਂ ਕੁ ਲਾਭ ਪੇਂਡੂ ਖੇਤਰਾਂ ਵਿੱਚ ਮਿਲਦਾ ਹੈ